ਹੈਲੋ ਹੈਲੋ ਹਾਂਜੀ ਕੌਣ ਬੋਲਦੇ ਜੀ ਅੱਛਾ ਜੀ ਹੋਰ ਕੀ ਹਾਲ ਹੈ ਜੀ ਅੱਛਾ ਜੀ ਅੱਛਾ ਜੀ ਕਦੇ ਮਿਲੇ ਨਹੀਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਹਾਂ ਤਾਹੀਓ ਮੈਂ ਵੀ ਬਾਹਰ ਨਿਕਲਦੀ ਨਹੀਂ ਕਦੇ ਧਿਆਨ ਨਹੀਂ ਕਰਿਆ ਅੱਛਾ ਹੋਰ ਜੀ ਅੱਛਾ ਜੀ ਦੱਸੋ ਜੀ ਕੀ ਕੰਮ ਹੈ ਅੱਛਾ ਅੱਛਾ ਅੱਛਾ ਰੇਹੜੀਆਂ ਵਾਲੇ ਤਾਂ ਮਹਿੰਗੀ ਹੀ ਦਿੰਦੇ ਹੈ ਅੱਛਾ ਅੱਛਾ ਅੱਛਾ ਮੈਨ ਹਾਂ ਹਾਂ ਉਹ ਹੀ ਤਾਂ ਹੈ ਹਮ ਹਾਂ ਹਾਂਜੀ ਮਿਲਦੀ ਜ਼ਰੂਰ ਮੈਂ ਤੁਹਾਨੂੰ ਦੱਸ ਦੂ ਦੱਸ ਦਿੰਦੀ ਹਾਂ ਇੱਕ ਤਾਂ ਅਨਾਜ ਮੰਡੀ 'ਚ ਹੈ ਸਬਜ਼ੀ ਮੰਡੀ ਹੈਗੀ ਹੈ ਇੱਕ ਗਿਲਕੋ ਵਿੱਚ ਮੰਡੀ ਲੱਗਦੀ ਹੈ ਸਬਜ਼ੀ ਦੀ ਫਰੈਸ਼ ਸਬਜ਼ੀਆਂ ਹੁੰਦੀਆਂ ਉੱਥੇ ਅਤੇ ਇੱਕ ਦੁਸਹਿਰਾ ਗਰਾਉਂਡ ਵਿੱਚ ਹੈ ਇੱਕ ਰਿਲਾਇੰਸ ਵਿੱਚ ਹੈ ਬਾਕੀ ਤੁਸੀਂ ਦੇਖ ਲਿਓ ਜਿਵੇਂ ਕਰਨਾ ਹੈ ਅਗਰ ਮੇਰੇ ਹਮ ਹਾਂਜੀ ਦੁਸਹਿਰਾ ਗਰਾਉਂਡ ਤਾਂ ਸ਼ਨੀਵਾਰ ਨੂੰ ਲੱਗਦੀ ਹੈ ਹਾਂਜੀ ਬਾਕੀ ਜਿਹੜੀ ਸਬਜ਼ੀ ਮੰਜੀ ਮੰਡੀ ਵਿੱਚ ਅਨਾਜ ਮੰਡੀ ਹੈ ਉਹ ਵਾਲੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਹਰ ਟਾਈਮ ਏ ਮਤਲਬ ਕਿ ਅਤੇ ਬਾਕੀ ਮੇਰੇ ਜਾਣ ਪਛਾਣ ਵੀ ਹੈਗੇ ਕਈਆਂ 'ਤੇ ਮੈਂ ਲੈਂਦੀ ਜਿਨ੍ਹਾਂ 'ਤੇ ਸਬਜ਼ੀ ਕੋਈ ਗੱਲ ਨਹੀਂ ਤੁਸੀਂ ਚੱਲੇਓ ਮੇਰੇ ਨਾਲ ਮੈਂ ਤੁਹਾਨੂੰ ਲੈ ਜੂੰਗੀ ਨਾਲ ਬਾਕੀ ਤੁਹਾਨੂੰ ਜਿਵੇਂ ਠੀਕ ਲੱਗਿਆ ਰੇਟ ਫਿਰ ਉੱਥੋਂ ਲੈ ਲੇ ਕਰਿਓ ਫਰੈਸ਼ ਸਬਜ਼ੀ ਹੁੰਦੀ ਹੈ ਰੇਟ ਸਹੀ ਹੁੰਦਾ ਹੈ ਅਤੇ ਸਬਜ਼ੀ ਵੀ ਫਰੈਸ਼ ਹੁੰਦੀ ਹੈ ਅੱਜ ਸ਼ਾਮ ਨੂੰ ਚੱਲਿਓ ਫਿਰ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਫ਼ੋਨ ਕਰ ਦੂੰਗੀ ਇਹੀ ਨੰਬਰ ਹੈ ਨਾ ਤੁਹਾਡਾ ਠੀਕ ਹੈ ਜੀ ਓਕੇ ਜੀ ਓਕੇ ਜੀ ਬਾਏ ਜੀ